ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਅਰੁਨਾ ਬੋਲ ਰਹੀ ਹਾਂ ਤੁਹਾਡੇ ਰੈਸਟੋਰੈਂਟ ਤੋਂ ਖਾਣਾ ਮੰਗਵਾਇਆ ਅਤੇ ਤੁਹਾਡਾ ਜਿਹੜਾ ਬੰਦਾ ਆਇਆ ਉਹਨੇ ਡੀਲ ਨਹੀਂ ਚੰਗੀ ਤਰ੍ਹਾਂ ਕੀਤਾ ਸਾਨੂੰ ਉਹ ਨਾ ਇੱਕ ਆਇਆ ਲੇਟ ਇੱਕ ਸਾਡਾ ਦਰਵਾਜ਼ਾ ਭੰਨੀ ਗਿਆ ਅਤੇ ਅਸੀਂ ਉਹਨੂੰ ਮੈਂ ਉਹਨੂੰ ਬੋਲੀ ਵੀ ਤੂੰ ਬੈੱਲ ਕਰਨੀ ਸੀ ਤਾਂ ਕਹਿੰਦਾ ਮੈਨੂੰ ਨਹੀਂ ਲੱਭੀ ਬੈੱਲ ਮੈਂ ਕਿਹਾ ਵੀ ਸਾਹਮਣੇ ਲੱਗੀ ਦੀ ਹੈ ਅਤੇ ਕਹਿੰਦਾ ਨਹੀਂ ਮੈਨੂੰ ਨਹੀਂ ਦਿਸੀ ਅਤੇ ਮੈਂ ਕਿਹਾ ਤੂੰ ਐਨੀ ਲੇਟ ਆਇਆ ਵਾਂ ਇਹ ਕੋਈ ਗੱਲ ਹੈ ਅਤੇ ਕਹਿੰਦਾ ਰੋਟੀ ਤਾਂ ਲੈ ਹੀ ਆਇਆ ਨਾ ਅਤੇ ਮੈਂ ਕਿਹਾ ਇਹ ਕੋਈ ਟੈਮ ਥੋੜ੍ਹੀ ਹੈ ਤੂੰ ਬੋਲਦਾ ਕਿੱਦਾਂ ਪਿਆ ਵਾਂ ਅਤੇ ਕਹਿੰਦਾ ਮੈਂ ਲਿਆਤੀ ਹੈ ਰੋਟੀ ਅਤੇ ਆਹ ਲੈ ਲਓ ਅਤੇ ਮੈਂ ਪੈਸੇ ਵੀ ਦਿੱਤੇ ਹੈ ਉਹਨੂੰ ਸਾਰਾ ਕੁਛ ਕੀਤਾ ਵੀ ਅੱਗੇ ਤੁਹਾਡੇ ਕੋਲੋਂ ਹੀ ਖਾਣਾ ਮੰਗਾਉਂਦੇ ਰਹੇ ਹਾਂ ਤੁਹਾਡੇ ਬੰਦੇ ਬਹੁਤ ਵਧੀਆ ਡੀਲ ਕਰਦੇ ਰਹੇ ਹੈ ਬੜੇ ਪਿਆਰ ਨਾਲ ਬੋਲਦੇ ਰਹੇ ਹੈ ਅਤੇ ਇਹ ਸਾਨੂੰ ਕਿੰਨਾ ਨਹੀਂ ਬਹੁਤ ਬੇਢੰਗੀ ਬੋਲ ਕੇ ਗਿਆ ਵਾ ਇਹੋ ਜਿਹੇ ਬੰਦੇ ਤੁਸੀਂ ਕਿਉਂ ਰੱਖਦੇ ਹੋ ਵਈ ਜਿਹੜਾ ਤੁਸੀਂ ਪਹਿਲੋਂ ਸੀ ਉਹ ਤੁਹਾਡੇ ਵਧੀਆ ਸੀ ਉਹ ਆਉਂਦੇ ਸੀ ਰੋਟੀ ਦਿੰਦੇ ਸੀ ਪਿਆਰ ਨਾਲ ਬੋਲਦੇ ਸੀ ਅਸੀਂ ਪੈਸੇ ਵੀ ਦਿੰਦੇ ਸੀ ਇਹਨੂੰ ਵੀ ਦਿੱਤੇ ਹੈ ਅਤੇ ਇਹ ਬੋਲਿਆ ਨਹੀਂ ਚੰਗਾ ਗਲਤ ਬੋਲਿਆ ਇਹੋ ਜਿਹੇ ਅੱਗੇ ਤੋਂ ਸਾਡੇ ਘਰ ਇੱਦਾਂ ਦਾ ਬੰਦਾ ਨਹੀਂ ਭੇਜਣਾ ਨਹੀਂ ਤਾਂ ਅਸੀਂ ਤੁਹਾਡੇ ਕੋਲ ਖਾਣਾ ਨਹੀਂ ਮੰਗਵਾਇਆ ਕਰਨਾ ਅਤੇ ਤੁਸੀਂ ਇਹ ਬਾਕੀ ਤੁਸੀਂ ਆਪੇ ਦੇਖੋ ਕਿੰਨਾ ਨਹੀਂ ਵੀ ਆਹ ਕੀ ਕਿਉਂ ਪੁੱਛੋ ਸਹੀ ਇਹਨੂੰ ਵੀ ਐਦਾਂ ਕਿਉਂ ਬੋਲਦਾਂ ਵੀ ਅੱਗੇ ਵੀ ਕਸਟਮਰ ਤੁਹਾਡੇ ਖਰਾਬ ਹੋਣੇ ਹੈ ਸਾਡਾ ਤਾਂ ਕੁਛ ਜਾਣਾ ਨਹੀਂ ਅਸੀਂ ਤਾਂ ਕਿੰਨਾ ਨੇ ਆਪੇ ਕਿੰਨਾ ਨੇ ਮੰਗਵਾ ਲੈਣੀ ਹੈ ਹੋਰ ਤੁਹਾਡੇ ਤੋਂ ਨਹੀਂ ਹੋਰ ਕਿਤੋਂ ਮੰਗਵਾ ਲਵਾਂਗੇ ਅਤੇ ਬਾਕੀ ਤੁਹਾਡੀ ਕਿੰਨਾ ਨਹੀਂ ਇੱਛਾ ਇਹਨੂੰ ਪੁੱਛੋ ਤੁਸੀਂ ਆਪੇ